ਜਿਵੇਂ ਪੰਜਾਬ ਵਿੱਚ ਤਾਂ ਬਹੁਤ ਤਰ੍ਹਾਂ ਦੇ ਸ ਸੱਭਿਆਚਾਰਿਕ ਵਿਸ ਵਿਰਾਸਤ ਨੇ ਜਿਵੇਂ ਕਿ ਸ਼ਿਲਪਕਾਰੀਆਂ ਨੇ ਕਲਾ ਨੇ ਜਿਵੇਂ ਪੱਖੀ ਬੁਣਨਾ ਨਾਲੇ ਬੁਣਨਾ ਛਿੱਕੂ ਬੁਣਨਾ ਕਲਾਵਾਂ ਬਣਾਉਣਾ ਮਿੱਟੀ ਦੇ ਪੁਤਲੇ ਵਗੈਰਾ ਬਣਾਉਣਾ ਫੁਲਕਾਰੀਆਂ ਬੁਣਨੀਆਂ ਇਸ ਤਰੀਕੇ ਦੀਆਂ ਬਹੁਤ ਜਿਹੜੀਆਂ ਸ਼ਿਲਪਕਾਰੀਆਂ ਅਤੇ ਕਲਾ ਨੇ ਆਪਣੇ ਪੰਜਾਬ ਵਿੱਚ ਉਹਨਾਂ ਦੀਆਂ ਜਿਹੜੀਆਂ ਸੰਭਾਲ ਹੈ ਕਿ ਆਪਾਂ ਚਾਹੁੰਦੇ ਹਾਂ ਕਿ ਉਸਨੂੰ ਪਛਾੜਿਆ ਨਾ ਜਾਵੇ ਉਸਨੂੰ ਅੱਜ ਵੀ ਆਪਦੇ ਨਾਲ ਲੈ ਕੇ ਜਾਇਆ ਜਾਵੇ ਕਿ ਜਿਸ ਕਰਕੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਪੰਜਾਬ ਦੀ ਜਿਹੜੀ ਕਲਾ ਹੈ ਅਤੇ ਸ਼ਿਲਪਕਾਰੀ ਹੈ ਉਸ ਦੀਆਂ ਜਿਹੜੀਆਂ ਭੂਮਿਕਾ ਨੇ ਹੈ ਨਾ ਉਸ ਉਸ ਤੋਂ ਉਸ ਤੋਂ ਜਾਣੂ ਹੋ ਸਕਣ ਤਾਂ ਕਿਸੇ ਵੀ ਚੀਜ਼ ਨੂੰ ਪਿਛੋਕੜ ਨਾ ਕੀਤਾ ਜਾ ਸਕੇ ਹਰ ਇੱਕ ਚੀਜ਼ ਦੀ ਸੰਭਾਲ ਕੀਤੀ ਜਾਵੇ ਜੋ ਵੀ ਸੱਭਿਆਚਾਰਕ ਕਲਾ ਅਤੇ ਸ਼ਿਲਪਕਾਰੀ ਆ ਉਹਨਾਂ ਦੀ ਸੰਭਾਲ ਕੀਤੀ ਜਾਵੇ ਮਿਊਜ਼ੀਅਮਸ ਬਣਾਏ ਜਾਣ ਉਹਨਾਂ ਵਿੱਚ ਕਲਾਵਾਂ ਦਾ ਪ੍ਰਦਰਸ਼ਨ ਕੀਤਾ ਜਾਵੇ ਉਹਦੇ ਨਾਲ ਉਹਨਾਂ ਨੂੰ ਵਧੀਆ ਸਾਂਭ ਸਾਂਭ ਕੇ ਰੱਖਿਆ ਜਾਵੇ ਹਰ ਜਿਵੇਂ ਵੱਡੇ ਵੱਡੇ ਕਾਲਜ ਹੈ ਯੂਨੀਵਰਸਿਟੀਜ ਹੈ ਉਹਨਾਂ ਵਿੱਚ ਵੀ ਕਲਾ ਅਤੇ ਸ਼ਿਲਪਕਾਰੀਆਂ ਨੂੰ ਸੰਭਾਲ ਕੇ ਰੱਖਿਆ ਜਾਵੇ ਉਹਨਾਂ ਦੇ ਵੀ ਇੱਕ ਬਹੁਤ ਤਰੀਕੇ ਨਾਲ ਵਧੀਆ ਸੰਭਾਲ ਕੀਤੀ ਜਾ ਸਕੇ ਕਿ ਜਿਸ ਕਰਕੇ ਜੋ ਕੋਈ ਵੀ ਉਹਨਾਂ ਨੂੰ ਵੇਖੇ ਉਸਨੂੰ ਜਾਣਨ ਵਾਸਤੇ ਉਤਸਾਹਿਤ ਹੋਵੇ ਉਸਨੂੰ ਜਾਣੋ ਉਸ ਨਾਲ ਜਾਣੂ ਹੋ ਸਕੇ ਆਉਣ ਵਾਲੀ ਪੀੜ੍ਹੀ ਵੀ ਜਾਣੂ ਹੋ ਸਕੇ ਕਿ ਹਾਂ ਕਿ ਇਹ ਸਾਡੀ ਕਲਾ ਅਤੇ ਸ਼ਿਲਪਕਾਰੀਆਂ ਨੇ ਪੰਜਾਬ ਦੀਆਂ ਇਹ ਸੱਭਿਆਚਾਰਕ ਵਿਰਾਸਤ ਦੇ ਆਉਣ ਦੇ ਸਮੇਂ ਵਿੱਚ ਵੀ ਬਹੁਤ ਜ਼ਰੂਰੀ ਨੇ ਇਹਨਾਂ ਦੀ ਸਾਂਭ ਇਹਨਾਂ ਦੀ ਦੇਖ ਰੇਖ ਕਰਨੀ ਬਹੁਤ ਜ਼ਰੂਰੀ ਹੈ ਇਸ ਨੂੰ ਹਰ ਜੇ ਮਾਡਰਨ ਜ਼ਮਾਨੇ ਦੇ ਨਾਲ ਨਾਲ ਇਸ ਨੂੰ ਲੈ ਕੇ ਜਾਣਾ ਚਾਹੀਦਾ ਹੈ